ਮੈਨੂੰ ਯਾਦ ਹੈ ਕੁਛ ਸ ਟਾਈਮ ਪਹਿਲੇ ਮੇਰੇ ਜਿਹੜੇ ਰਿਸ਼ਤੇਦਾਰ ਸੀਗੇ ਉਹ ਜਿਹੜੇ ਦੂਜੇ ਸਟੇਟ ਵਿੱਚ ਰਹਿੰਦੇ ਨੇ ਉਹ ਇੱਥੇ ਆਏ ਸੀਗੇ ਪੰਜਾਬ ਘੁੰਮਣ ਫਿਰਨ ਵਾਸਤੇ ਅਤੇ ਉਹਨਾਂ ਦੇ ਨਾਲ ਉੱਥੇ ਦੇ ਉਹਨਾਂ ਦੇ ਕੁਛ ਦੋਸਤ ਵੀ ਆਏ ਸੀਗੇ ਜਿਹੜੇ ਪੰਜਾਬੀ ਬਿਲਕੁਲ ਵੀ ਨਹੀਂ ਜਾਣਦੇ ਸੀਗੇ ਅਤੇ ਉਹ ਮੈਨੂੰ ਕਹਿਣ ਲੱਗੇ ਕਿ ਉਹ ਇੱਥੇ ਦੇ ਜਿਹੜੇ ਧਾਰਮਿਕ ਸਥਲ ਨੇ ਅਤੇ ਹੋਰ ਵੀ ਜਿਹੜੇ ਪ੍ਰੈਟਨ ਸਥਲ ਨੇ ਉਹ ਦੇਖਣਾ ਚਾਹੁੰਦੇ ਨੇ ਅਤੇ ਮੈਂ ਉਹਨਾਂ ਨੂੰ ਨਾਲ਼ ਲੈ ਕੇ ਗਈ ਉਹਨਾਂ ਨੂੰ ਦਿਖਾਇਆ ਘੁੰਮਾਇਆ ਫਿਰਾਇਆ ਸਾਰਾ ਕੁਛ ਦੱਸਿਆ ਉਹਨਾਂ ਨੂੰ ਅਤੇ ਜਿਹੜੀ ਚੀਜ਼ ਉਹਨਾਂ ਨੂੰ ਪੰਜਾਬੀ ਦੇ ਵਿੱਚ ਸਮ ਪਤ ਨਹੀਂ ਪਤਾ ਸੀਗੀ ਉਸ ਚੀਜ਼ ਬਾਰੇ ਉਸ ਤੋਂ ਰਿਲੇਟਡ ਜਿਹੜੀ ਵੀ ਗੱਲਾਂ ਸੀਗੀਆਂ ਮੈਂ ਉਹਨਾਂ ਨੂੰ ਪੰਜਾਬੀ ਦੇ ਵਿੱਚ ਉਹਨਾਂ ਨੂੰ ਅੱਛੀ ਤਰ੍ਹਾਂ ਦੱਸੀਆਂ ਅਤੇ ਉਹਨਾਂ ਨੂੰ ਉਹਨਾਂ ਦੀ ਹੀ ਭਾਸ਼ਾ ਦੇ ਵਿੱਚ ਜਿਹੜੀ ਉਹ ਸਮਝਦੇ ਸੀਗੇ ਹਿੰਦੀ ਚਾਹੇ ਇੰਗਲਿਸ਼ ਮੈਂ ਉਹਨਾਂ ਨੂੰ ਉਹਦੇ ਵਿੱਚ ਇਨ੍ਹਾਂ ਨੂੰ ਟ੍ਰਾਂਸਲੇਟ ਕਰਕੇ ਸਮਝਾਈਆਂ ਅਤੇ ਮੇਰਾ ਜਿਹੜਾ ਇਹ ਅਨੁਭਵ ਸੀਗਾ ਬਹੁਤ ਹੀ ਅੱਛਾ ਸੀਗਾ ਅਤੇ ਉਹਨਾਂ ਨੂੰ ਵੀ ਇੱਥੇ ਆ ਕੇ ਬਹੁਤ ਹੀ ਅੱਛਾ ਲੱਗਿਆ